ਮੈਂ ਬਹੁਤ ਸਾਰੀਆਂ ਕਿਤਾਬਾਂ ਬਹੁਤ ਸਾਰੇ ਨਾਵਲ ਪੜ੍ਹੇ ਹਨ ਜਿਹਨਾਂ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਇਤਿਹਾਸਿਕ ਮਨਪਸੰਦ ਕਿਤਾਬਾਂ ਹਨ ਮੇਰੇ ਕੋਲ ਜਿਵੇਂ ਕਿ ਕੰਪਿਊਟਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਹਨ ਤਾਂ ਮੈਂ ਉਸ ਕਿਤਾਬਾਂ ਨੂੰ ਪੜ੍ਹਨ ਦੇ ਵਿੱਚ ਬਹੁਤ ਮੈਨੂੰ ਮੇਰਾ ਮਨੋਰੰਜਨ ਹੁੰਦਾ ਹੈ ਅਤੇ ਮੈਂ ਉਸ ਨੂੰ ਪੜ੍ਹਨ ਦੇ ਵਿੱਚ ਬਹੁਤ ਉਤਸ਼ਾਹ ਮੇਰਾ ਵਧਦਾ ਹੈ ਕਿਉਂਕਿ ਮੈਨੂੰ ਕੰਪਿਊਟਰ ਦੀਆਂ ਕਿਤਾਬਾਂ ਪੜ੍ਹਨੀਆਂ ਬਹੁਤ ਪਸੰਦ ਹਨ ਜਿਵੇਂ ਕਿ ਮੈਂ ਪੈਹੁ ਨੇ ਹੀ ਇੱਕ ਪਾਈਥਨ ਦੀ ਕਿਤਾਬ ਪੜ੍ਹੀ ਹੈ ਜੋ ਕਿ ਮਿਸ ਪਲਵੀ ਅਰੋੜਾ ਨੇ ਲਿਖੀ ਹੋਈ ਹੈ ਤਾਂ ਉਸ ਦੇ ਵਿੱਚ ਕੀ ਹੈ ਪਾਇਥਨ ਦਾ ਬੇਸਿਕ ਤੋਂ ਲੈ ਕੇ ਅਡਵਾਂਸ ਤੱਕ ਸਭ ਕੁਝ ਦੱਸਿਆ ਗਿਆ ਹੈ ਜਿਸ ਦੇ ਵਿੱਚ ਅਸੀਂ ਉਸ ਕਿਤਾਬ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸਾਡੀ ਨਵੀਂ ਟੈਕਨੋਲਜੀ ਜਿਵੇਂ ਕਿ ਹੁਣ ਸਾਡੀ ਈ ਇਨਫੋਰਮੇਸ਼ਨ ਟੈਕਨੋਲਜੀ ਜੋ ਕਿ ਸਾਡੀ ਸਾਰੀ ਹੀ ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ 'ਤੇ ਬੇਸ ਹੁੰਦੀ ਹੈ ਆਰਟੀਫਿਸ਼ਅਲ ਇੰਟੈਲੀਜੈਂਸ ਮਤਲਬ ਕਿ ਦਿਮਾਗ ਆਪਣਾ ਬਿਲਕੁਲ ਇਨਸਾਨਾਂ ਵਾਂਗੂੰ ਉਸਦੇ ਵਿੱਚ ਕੰਮ ਕਰਦਾ ਹੈ ਅਸੀਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਇਸ ਤਰ੍ਹਾਂ ਦੀਆਂ ਰੋਬੋਟ ਤਿਆਰ ਕਰਦੇ ਹਾਂ ਜਿਸ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਜੋ ਵੀ ਸਾਡਾ ਕੰਮ ਹੈ ਉਹ ਅਸੀਂ ਆਸਾਨ ਕਰ ਪਾਈਏ ਅਤੇ ਅਸੀਂ ਬਿਨਾਂ ਕਿਸੇ ਏ ਮਸ਼ੀਨ ਤੋਂ ਹੀ ਸਾਰੇ ਕੰਮ ਕਰ ਪਾਈਏ ਇਹੀ ਹੀ ਸਾਡੀਆਂ ਕਿਤਾਬਾਂ ਦੇ ਵਿੱਚ ਇਨਫੋਰਮੇਸ਼ਨ ਦੇ ਵਿੱਚ ਲਿਖਿਆ ਹੋਇਆ ਹੈ